ਹੈਲੋ ਕਿਥੋਂ ਫਾਜਿਲਕਾ ਤੇ ਅੱਛਾ ਅੱਛਾ ਤੁਹਾਡੇ ਫਾਜ਼ਿਲਕਾ ਚ ਬੜਾ ਟਰੈਫਿਕ ਹੁੰਦਾ ਹੈ ਤੇ ਆਹ ਗਊਸ਼ਾਲਾ ਰੋਡ ਤੇ ਐਨਾ ਟ੍ਰੈਫਿਕ ਐ ਉਰੇ ਘੰਟਾ ਘਰ ਤੇ ਕਾਰ ਸਾਇਕਲ ਵੀ ਟੱਪਣਾ ਔਖਾ ਹੁੰਦਾ ਟ੍ਰੈਫਿਕ ਬਹੁਤ ਜਿਆਦਾ ਹੁੰਦਾ ਜਿਸ ਪਾਸੇ ਜਾਈਏ ਫਿਰ ਉੱਧਰ ਟ੍ਰੈਫਿਕ ਹੀ ਟ੍ਰੈਫਿਕ ਹੁੰਦਾ ਐ ਪੈਦਲ ਵੀ ਤੁਰਨਾ ਬੜਾ ਔਖਾ ਹੋ ਜਾਂਦਾ ਐ ਕੋਈ ਟਰੈਫਿਕ ਦਾ ਇਹ ਨਹੀਂ ਮਤਲਬ ਜਿਆਦਾ ਟਰੈਫਿਕ ਹੋ ਜਾਂਦਾ ਹੈ ਕੋਈ ਸਿਕਿਉਰਟੀ ਓਹ ਟਰੈਫਿਕ ਤੇ ਨਿਕਲਾ ਬੜਾ ਮੁਸ਼ਕਿਲ ਹੁੰਦਾ ਸਾਈਕਲ ਤੇ ਕੀ ਪੈਦਲ ਵੀ ਤੁਰਨਾ ਔਖਾ ਹੋ ਜਾਂਦਾ ਹੈ ਟਰੈਫਿਕ ਤੇ ਬੜਾ ਹੁੰਦਾ ਤੇ ਤੁਰਨਾ ਫਿਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਟ੍ਰੈਫਿਕ ਇਹ ਇਧਰ ਵੀ ਸਾਈਡ ਗਏ ਆਪਣੇ ਸ਼ਾਸਤਰੀ ਚੋਕ ਤੇ ਉਧਰ ਵੀ ਟ੍ਰੈਫਿਕ ਹੀ ਟ੍ਰੈਫਿਕ ਆ ਸਰਾਫਾ ਬਜਾਰ ਘੰਟਾ ਘਰ ਰੇਲਵੇ ਸਟੇਸ਼ਨ ਬਸ ਸਟੈਂਡ ਟਰੈਫਿਕ ਤੇ ਨਿਕਲਨਾ ਬੜਾ ਮੁਸ਼ਕਿਲ ਹੋ ਜਾਤਾ ਹੈ ਸਾਈਕਲ ਵੀ ਨਹੀਂ ਨਿਕਲਦੀ ਹੈ ਸਾਈਕਲ ਵੀ ਨਿਕਲਨਾ ਬੜਾ ਔਖਾ ਐ ਬੰਦਾ ਪੈਦਲ ਤੋ ਤੁਰਦਾ ਐ ਉਹ ਵੀ ਬੜੇ ਅਤੇ ਇੱਧਰ ਉੱਧਰ ਤੁਰ ਫਿਰ ਕੇ ਨਿਕਲਦਾ ਏ ਚਲੋ ਠੀਕ ਹੈ ਜੀ